ਕੀ ਮੇਰੀ ਗੱਲ ਕ੍ਰਿਸਪੀ ਬਾਈਟਸ 'ਚ ਹੋ ਰਹੀ ਹੈ ਮੈਂ ਅਮਨ ਗੱਲ ਕਰ ਰਿਹਾ ਹਾਂ ਮੈਂ ਹੁਣ ਹੀ ਤੁਹਾਡੇ ਰੈਸਟੋਰੈਂਟ ਤੋਂ ਮੋਮੋਜ਼ ਮਲਾਈ ਚਾਪ ਅਤੇ ਦੋ ਕੋਲਡ੍ਰਿੰਕਸ ਆਰਡਰ ਕੀਤੀਆਂ ਨੇ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਆਰਡਰ ਕਦੋਂ ਤੱਕ ਡਿਲੀਵਰ ਹੋ ਜਾਵੇਗਾ ਅਤੇ ਇੱਕ ਚੀਜ਼ ਹੋਰ ਮੈਂ ਜੋ ਇਹ ਪੇਮੈਂਟ ਕਰਨੀ ਹੈ ਉਹ ਔਨਲਾਈਨ ਕਰਨੀ ਹੈ ਪਲੀਜ਼ ਆਪਣੇ ਡਿਲੀਵਰੀ ਬੋਏ ਕੋਲ਼ ਸਕੈਨਰ ਜ਼ਰੂਰ ਭੇਜਣਾ